ਮੈਂ ਪੰਜਾਬੀ ਸਾਹਿਤ ਦੇ ਲੇਖ ਕਵਿਤਾਵਾਂ ਪੜ੍ਹਨ ਦਾ ਸ਼ੌਕੀਨ ਹਾਂ ਅਤੇ ਸਾਡੇ ਸਮਕਾਲੀ ਲਿਖਤਾਂ ਦੇ ਵਿੱਚ ਕਈ ਵਧੀਆ ਵਧੀਆ ਲੇਖਕ ਹੋਏ ਨੇ ਪੰਜਾਬ ਦੇ ਵਿੱਚ ਭਾਈ ਵੀਰ ਸਿੰਘ ਦੇਸ਼ ਦੇ ਬਹੁਤ ਵਧੀਆ ਲੇਖਕ ਨੇ ਰਬਿੰਦਰ ਨਾਥ ਟੈਗੋਰ ਮੁਨਸ਼ੀ ਪ੍ਰੇਮ ਚੰਦ ਇਹਨਾਂ ਦੀਆਂ ਲਿਖਤਾਂ ਮੈਂ ਬਹੁਤ ਪੜ੍ਹੀਆਂ ਹਨ ਜਿਨ੍ਹਾਂ ਦੇ ਵਿੱਚ ਕਿ ਦੇਸ਼ ਦੀ ਤਰੁੱਟੀਆਂ ਜਿਹੜੀਆਂ ਆਮ ਜਨਤਾ ਦੇ ਵਿੱਚ ਗਲਤੀਆਂ ਤਰੁੱਟੀਆਂ ਅਤੇ ਦੋਸ਼ ਜਿਹੜੇ ਸਾਡੇ ਦੇਸ਼ ਨੂੰ ਕੁਰੇਦ ਰਹੇ ਨੇ ਇਹਨਾਂ ਨੂੰ ਸ਼ੋ ਕੀਤਾ ਜਾਂਦਾ ਹੈ ਇਹਨਾਂ ਕਵਿਤਾਵਾਂ ਵਿੱਚ ਅਤੇ ਇਹਨਾਂ ਲੇਖਕਾਂ 'ਚ ਅਤੇ ਇਹਨਾਂ ਦੇ ਨਾਟਕ ਰੂਪਾਂਤਰ ਤੌਰ 'ਤੇ ਜਿਹੜੇ ਨਾਟਕ ਕੀਤੇ ਜਾਂਦੇ ਨੇ ਇਹਨਾਂ ਵਿੱਚ ਬਹੁਤ ਬਹੁਤ ਮਸ਼ਹੂਰ ਵੀ ਨੇ ਜਿਨ੍ਹਾਂ ਵਿੱਚ ਕਿ ਦੇਸ਼ ਦੀਆਂ ਅਤੇ ਪ੍ਰਦੇਸ਼ ਦੀਆਂ ਕੁ ਤਰੁਟੀਆਂ ਨੂੰ ਲੋਕਾਂ ਦੇ ਅੱਗੇ ਉਜਾਗਰ ਕੀਤਾ ਜਾਂਦਾ ਹੈ ਜਿਸ ਵਿੱਚ ਕਿ ਦੁਨੀਆ ਦੇ ਜਿਹੜੇ ਬੱਚੇ ਨੇ ਜਾਂ ਅੱਗੇ ਪੜ੍ਹੇ ਲਿਖੇ ਲੋਕ ਨੇ ਉਹ ਇਹਨਾਂ ਦੇ ਵਿੱਚ ਸਾਡੇ ਦੇਸ਼ ਦਾ ਜਿੱਦਾਂ ਨਸ਼ਿਆਂ ਦੇ ਬਾਰੇ ਜਾਂ ਦੇਸ਼ ਦੀਆਂ ਹੋਰ ਕੁੱਝ ਦਹੇਜ ਪ੍ਰਥਾ ਦੇ ਬਾਰੇ ਜਾਂ ਦੇਸ਼ ਦੀ ਸਹੂਲਤਾਂ ਨੂੰ ਲੋਕਾਂ ਦੇ ਅੱਗੇ ਲਿਆਉਣਾ ਜਾਂ ਲੋਕਾਂ ਨੂੰ ਸੁਚੇਤ ਕਰਨਾ ਕਿ ਗਲਤ ਤੌਰ ਤੋਂ ਬਾਹਰ ਆਓ ਵਧੀਆ ਸਿੱਖੋ ਵਧੀਆ ਪੜ੍ਹੋ ਅਤੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜਿਹਦੇ ਵਿੱਚ ਕਿ ਦੇਸ਼ ਦੀ ਤਰੱਕੀ ਹੋਏ ਔਰ ਲੋਕ ਸੁਚਾਰੂ ਤੌਰ 'ਤੇ